ਸਤਾਰਾਂ ਜਨਵਰੀ ਦੋ ਹਜ਼ਾਰ ਪੰਦਰਾਂ ਬਾਈ ਫਰਵਰੀ ਦੋ ਹਜ਼ਾਰ ਸੋਲਾਂ ਉੱਨੀ ਮਾਰਚ ਦੋ ਹਜ਼ਾਰ ਅਠਾਰਾਂ ਸਤਾਈ ਫਰਵਰੀ ਦੋ ਹਜ਼ਾਰ

ਵੀਹ ਅਗਸਤ ਦੋ ਹਜ਼ਾਰ ਇੱਕੀ